ਮੈਂ ਜੋ ਔਡਰ ਕੀਤਾ ਸੀਗਾ ਔਡਰ ਨੰਬਰ ਚੌਦਾਂ ਹੈ ਅਤੇ ਮੈਂ ਇਹ ਔਡਰ ਕੈਂਸਲ ਕਰਨਾ ਸੀ ਮੈਂ ਕਿਸੇ ਕਾਰਨ ਕਰਕੇ ਇਹ ਔਡਰ ਨਹੀਂ ਮੰਗਵਾ ਸਕਦੀ ਕਿਰਪਾ ਕਰਕੇ ਮੈਨੂੰ ਇਹ ਔਡਰ ਰਿਫੰਡ ਕੀਤਾ ਜਾ ਸਕਦਾ ਜਾਂ ਅਗਲੇ ਔਡਰ ਵਿੱਚ ਇਸ ਨੂੰ ਐਡਜਸਟ ਕੀਤਾ ਜਾ ਸਕਦਾ ਹੈ ਪਲੀਜ਼ ਮੈਂ ਇਹ ਔਡਰ ਨਹੀਂ ਪਿਕਅਪ ਕਰ ਸਕਦੀ ਕੋਈ ਕਿਸੇ ਵਜ੍ਹਾ ਕਾਰਨ ਕਰਕੇ ਕੋਈ ਪ੍ਰੋਬਲਮ ਹੈ ਇਸ ਕਰਕੇ ਮੈਨੂੰ ਇਸ ਔਡਰ ਦਾ ਜਲਦੀ ਤੋਂ ਜਲਦੀ ਕੋਈ ਉਹ ਦਿੱਤਾ ਜਾਵੇ ਤਾਂ ਜੋ ਮੈਂ ਰੱਦ ਕਰ ਸਕਾਂ ਜਾਂ ਮੈਨੂੰ ਇਸ ਔਡਰ ਦਾ ਰਿਫੰਡ ਦਿੱਤਾ ਜਾਵੇ ਜਾਂ ਮੈਨੂੰ ਅਗਲੀ ਡਿਲੀਵਰੀ ਵਿੱਚ ਅਗਲੇ ਔਡਰ ਵਿੱਚ ਇਸਦਾ ਭੁਗਤਾਨ ਦਿੱਤਾ ਜਾਵੇ